ਬੱਚਿਆਂ ਦੀਆਂ ਡਰਾਇੰਗ ਜਾਂ ਪੇਂਟਿੰਗ ਵਰਗੀਆਂ ਕਲਾਵਾਂ ਸ਼ੁਰੂ ਕਰਨ ਲਈ ਕੋਈ ਉਮਰ ਨਹੀਂ ਹੁੰਦੀ ਬੱਚਾ ਛੋਟਾ ਹੀ ਪੈਨਸਿਲ ਫੜਨ ਲੱਗ ਜਾਂਦਾ ਛੋਟੇ ਤਿੰਨ ਸਾਲ ਦੇ ਬੱਚੇ ਤੋਂ ਲੈ ਕੇ ਕੰਧਾਂ 'ਤੇ ਮਤਲਬ ਕਿ ਕੁਛ ਕੁਛ ਬਣਾਉਣ ਲੱਗ ਜਾਂਦੇ ਹਨ ਅਤੇ ਉਹ ਬੱਚੇ ਮਤਲਬ ਪੰਜ ਸਾਲ ਦੀ ਉਮਰ ਤੱਕ ਉਹ ਜ਼ਿਆਦਾ ਵਧੀਆ ਮੈਟਰ ਬਣਾਉਣ ਲੱਗ ਜਾਂਦੇ ਨੇ ਉਹਨਾਂ ਦਾ ਮਾਇੰਡ ਸ਼ਾਰਪ ਹੁੰਦਾ ਅਤੇ ਉਹ ਬੱਚੇ ਬੱਚੇ ਮਨ 'ਚ ਮਤਲਬ ਕਿ ਇੰਟਰਸਟ ਵੀ ਬਹੁਤ ਜ਼ਿਆਦਾ ਹੁੰਦਾ ਹੈ ਡਰਾਇੰਗ ਅਤੇ ਪੇਂਟਿੰਗ ਕਰਨ ਦਾ ਅੱਜ ਕੱਲ੍ਹ ਦੇ ਬੱਚੇ ਸਭ ਤੋਂ ਪਹਿਲਾਂ ਪੇਂਟਿੰਗ ਅਤੇ ਡਰਾਇੰਗ ਜ਼ਿਆਦਾ ਕਰਦੇ ਹਨ ਕਲਰ ਵਗੈਰਾ ਓਬਜ਼ਰਬ ਕਰਨ ਲਈ ਵਰਤਦੇ ਹਨ ਉਹ ਕਰਨ ਵਿੱਚ ਵੱਧਦੇ ਹਨ ਅਤੇ ਉਹਨਾਂ ਦਾ ਇੰਟਰਸਟ ਡਰਾਇੰਗ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਅਤੇ ਉਹ ਪੜ੍ਹਾਈ ਨਾਲ ਡਰਾਇੰਗ ਦੇ ਵਿੱਚ ਇੰਟਰਸਟ ਜ਼ਿਆਦਾ ਰੱਖਦੇ ਹਨ ਤਾਂ ਛੋਟੇ ਛੋਟੇ ਚਿੱਤਰ ਜਿਵੇਂ ਕਿ ਫਲੈਗ ਹਟ ਇਹ ਇਹੋ ਜਿਹੀਆਂ ਚੀਜ਼ੀਆਂ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਡਰੋਅ ਕਰ ਲੈਂਦੇ ਹਨ ਅਤੇ ਉਹਨਾਂ ਵਿੱਚ ਪੇਂਟਿੰਗ ਕਰਨਾ ਉਹਨਾਂ ਨੂੰ ਵਧੀਆ ਲੱਗਦਾ ਹੈ ਬੱਚਿਆਂ ਦੇ ਮਨ ਭਾਉਂਦਾ ਹੋ ਜਾਂਦਾ ਹੈ ਉਨ੍ਹਾਂ ਦੇ ਬੱਚਿਆਂ ਦਾ ਮਨ ਵੀ ਲੱਗਿਆ ਰਹਿੰਦਾ ਹੈ ਅਤੇ ਉਸ ਵਿੱਚ ਬੱਚੇ ਬਹੁਤ ਇੰਟਰਸਟ ਰੱਖਦੇ ਹਨ ਅਤੇ ਹਨ ਅਤੇ ਇਹੋ ਇਸ ਇਹੋ ਜਿਹਿਆਂ ਚੀਜ਼ਾਂ ਨੂੰ ਪੇਂਟਿੰਗ ਡਰਾਇੰਗ ਵਗੈਰਾ ਕਰਨ ਲਈ ਬੱਚਿਆ ਨੂੰ ਦੱਸਿਆ ਜਾਵੇਂ ਤਾਂ ਬਹੁਤ ਜਲਦੀ ਕੈਚ ਅਪ ਕਰਦੇ ਹਨ ਬਹੁਤ ਜਲਦੀ ਸਿੱਖਦੇ ਹਨ ਅਤੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਡਰਾਇੰਗ 'ਚ ਇੰਟਰਸਟ ਕਰਦੇ ਹਨ ਅਤੇ ਵੱਡੇ ਹੋ ਕੇ 'ਚ ਇੰਟਰਸਟ ਬਣ ਜਾਂਦਾ ਹੈ ਅਤੇ ਬੱਚੇ ਇਸ ਲਾਈਨ ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਬਣਾ ਸਕਦਾ ਹੈ